ਹਾਂਜੀ ਬੋਲੋ ਜੀ ਹਾਂਜੀ ਹਾਂਜੀ ਅੱਪਡੇਟ ਤਾਂ ਇਹ ਹੀ ਆ ਅੱਜ ਕੱਲ੍ਹ ਓ ਐੱਸ ਟੀ ਬੈਚ ਦੀ ਘੱਟ ਆ ਰਹੀ ਹੈ ਅਤੇ ਤੁਸੀਂ ਹਾਂਜੀ ਘੱਟ ਆ ਰਹੀ ਹੈ ਅਤੇ ਤੁਸੀਂ ਆਪਣਾ ਟਾਰਗੇਟ ਸੈੱਟ ਕਰੋ ਵਧਾਉਣਾ ਠੀਕ ਹੈ ਕੰਮ ਸਲੋਅ ਨਹੀਂ ਹੋਣਾ ਬਿਲਕੁਲ ਵੀ ਠੀਕ ਹੈ ਹਾਂ ਕੰਮ ਸਲੋਅ ਨਹੀਂ ਹੋਣਾ ਚਾਹੀਦਾ ਕੰਮ ਪੂਰਾ ਘੱਟ ਆ ਰਹੀਆਂ ਪਹਿਲੇ ਬੈਚ ਦੀਆਂ ਪਿੱਛੇ ਸ਼ਿਕਾਇਤਾਂ ਉੱਪਰ ਤੋਂ ਬਹੁਤ ਆ ਰਹੀਆਂ ਠੀਕ ਹੈ ਕੰਮ ਪੂਰਾ ਕਰੋ ਆਪਣਾ ਖਿੱਚ ਕੇ ਰੱਖੋ ਕੰਮ ਹਾਂ ਪੂਰਾ ਕੰਮ ਓ ਐੱਸ ਟੀ ਜਿੰਨੀ ਵੀ ਹੈ ਨਾ ਜਿੰਨੀ ਘੱਟ ਰਹੀ ਹੈ ਹੁਣ ਤੁਸੀਂ ਪੂਰੀ ਕਰਨੀ ਹੈ ਠੀਕ ਹੈ ਜਿੱਦਾਂ ਵੀ ਹੋਣੇ ਮੈਨੂੰ ਅੱਪਡੇਟ ਕਰਨੀ ਹੈ ਹੋਰ ਗੱਲ ਬਾਤ ਕੋਈ ਨਹੀਂ ਬਸ ਉੱਪਰ ਆਪਣੇ ਬੈਚ ਪਰ ਧਿਆਨ ਦਓ ਪਹਿਲੇ ਬਹੁਤ ਘੱਟ ਆ ਰਹੀ ਹੈ ਬੈਚ ਦੀ ਠੀਕ ਹੈ ਮਾਲ ਪੂਰਾ ਕਰਕੇ ਦੇਣਾ ਹੈ ਅਸੀਂ ਠੀਕ ਹੈ ਕਲਾਇੰਟ ਨੂੰ ਆਪਣੇ ਨੂੰ ਬਹੁਤ ਘੱਟ ਆ ਰਿਹਾ ਸਟੋਕ ਘੱਟ ਆ ਰਿਹਾ ਪਿੱਛੋਂ ਘੱਟ ਆ ਰਹੀ ਹੈ ਬੈਚ ਦੀ ਠੀਕ ਹੈ ਅਸੀਂ ਵੀ ਉੱਪਰ ਘੱਟ ਤੇ ਘੱਟ ਦੋ ਸੌ ਤਾਂ ਹੋਣੀ ਚਾਹੀਦੀ ਮਿਨੀਮਮ ਪਹਿਲੇ ਘੱਟ ਆਏ ਇੱਕ ਸੌ ਵੀਹ ਤੀਹ ਆਇਆ ਮਾਲ ਦੋ ਸੌ ਕੁ ਤੋਂ ਦੋ ਸੌ ਪਲੱਸ ਹੀ ਹੋਣੀ ਚਾਹੀਦੀ ਹੈ ਠੀਕ ਹੈ ਦੋ ਸੌ ਕਿਲੋ ਦੀ ਬਰਾਬਰ ਆਉਣੀ ਚਾਹੀਦੀ ਹੈ ਮਾਲ ਦੀ ਢਾਈ ਸੌ ਤਾਂ ਕਰ ਦਿਓ ਢਾਈ ਸੌ ਵਾਲੇ ਨੂੰ ਆਪਣਾ ਪੂਰਾ ਟੀਮ ਪੂਰੀ ਕੰਮ ਕਰੋ ਟੀਮ ਵਰਕ ਕਰਕੇ ਠੀਕ ਹੈ ਦੈਨ ਹਾਂ ਜੇ ਕੋਈ ਕਮੀ ਹੈ ਦੱਸੋ ਕੋਈ ਪ੍ਰੋਬਲਮ ਆਈ ਦੱਸੋ ਕੋਈ ਹੈ ਕੋਈ ਪ੍ਰੋਬਲਮ ਆਉਂਦੀ ਚਲੋ ਠੀਕ ਹੈ ਅੱਪਡੇਟ ਕਰਦੇ ਰਿਹੋ ਜਿੱਦਾਂ ਵੀ ਹੈ ਠੀਕ ਹੈ ਓਕੇ ਓਕੇ